ਸਾਡੇ ਖੇਤਰ ਵਿੱਚ ਤਕਨੀਕੀ ਸਹਾਇਤਾ ਪ੍ਰਣਾਲੀਆਂ ਬਹੁਤ ਹੀ ਚੰਗਾ ਰੋਲ ਅਦਾ ਕਰਦੀਆਂ ਹਨ ਇਹ ਪ੍ਰਣਾਲੀਆਂ ਕਈ ਤਰੀਕੇ ਨਾਲ ਸਹਾਇਤਾ ਕਰਦੀਆਂ ਹਨ ਜਦੋਂ ਕਿਸੇ ਵੀ ਤਰ੍ਹਾਂ ਨਾਲ ਲਾਚਾਰ ਵਿਅਕਤੀ ਨੂੰ ਕਿਸੇ ਦੂਜੀ ਜਗ੍ਹਾ 'ਤੇ ਜਾਣਾ ਹੁੰਦਾ ਹੈ ਤਾਂ ਜਗ੍ਹਾ ਜਗ੍ਹਾ ਖੇਤਰ ਦੇ ਵਿੱਚ ਫੋਨ ਨੰਬਰ ਉਪਲਬਧ ਹਨ ਕੋਈ ਵੀ ਵਿਅਕਤੀ ਆਪਦੇ ਫੋਨ ਤੋਂ ਇਹਨਾਂ ਨੰਬਰਾਂ ਦੇ ਉੱਤੇ ਫੋਨ ਕਰਕੇ ਸਹਾਇਤਾ ਲੈ ਸਕਦਾ ਹੈ ਇਹ ਪ੍ਰਣਾਲੀਆਂ ਤੁਰੰਤ ਹੀ ਵੈਨ ਜਾਂ ਰਿਕਸ਼ਾ ਦੀ ਸਹਾਇਤਾ ਦਿੰਦੀਆਂ ਹਨ ਕਿਸੇ ਵੀ ਤਰ੍ਹਾਂ ਤੋਂ ਲਾਚਾਰ ਔਰਤ ਬੱਚਾ ਜਾਂ ਬੁੱਢਾ ਵਿਅਕਤੀ ਇਹਨਾਂ ਤੋਂ ਸਹਾਇਤਾ ਲੈ ਸਕਦਾ ਹੈ ਜੇਕਰ ਕਿਸੇ ਔਰਤ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਤਾਂ ਉਹ ਵੀ ਕਿਸੇ ਵੀ ਫੋਨ ਨੰਬਰ ਦੇ ਉੱਤੇ ਜਾ ਕੇ ਪੁਲਿਸ ਜਾਂ ਵੂਮੈਨ ਵੈਲਫੇਅਰ ਸੋਸਾਇਟੀ ਇਹਨਾਂ ਨੂੰ ਹਰ ਤਰੀਕੇ ਨਾਲ ਸਹਾਇਤਾ ਪਹੁੰਚਾਉਂਦੀਆਂ ਹਨ ਸਮਾਜ ਵਿੱਚ ਇਹਨਾਂ ਪ੍ਰਣਾਲੀਆਂ ਨੂੰ ਬਹੁਤ ਹੀ ਚੰਗਾ ਸਮਰਥਨ ਪ੍ਰਾਪਤ ਹੈ ਹਰ ਤਰ੍ਹਾਂ ਦੇ ਸਮਾਜਿਕ ਸਤਰਾਂ ਨਾਲ ਜੁੜੇ ਹੋਏ ਲੋਕ ਇਹਨਾਂ ਪ੍ਰਣਾਲੀਆਂ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਹਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੁੱਦਾ ਹੋਵੇ ਚਾਹੇ ਉਹ ਦਹੇਜ ਪ੍ਰਥਾ ਬਾਲ ਵਿਆਹ ਜਾਂ ਕਿਸੇ ਗਰੀਬ ਦੇ ਉੱਪਰ ਕੋਈ ਅੱਤਿਆਚਾਰ ਹੋ ਰਿਹਾ ਹੋਵੇ ਚਾਹੇ ਉਹ ਪੈਸੇ ਨਾਲ ਸੰਬੰਧਿਤ ਹੋਵੇ ਜਾਂ ਮਾਣਹਾਨੀ ਦਾ ਹੋਵੇ ਇਹ ਹਰ ਪ੍ਰਣਾਲੀਆਂ ਸਹਾਇਤਾ ਪ੍ਰਦਾਨ ਕਰਦੀਆਂ ਹਨ ਜੇਕਰ ਸਾਰੇ ਖੇਤਰ ਦੇ ਚੰਗੇ ਚੰਗੇ ਲੋਕ ਇਹਨਾਂ ਪ੍ਰਣਾਲੀਆਂ ਵਿੱਚ ਅਹਿਮ ਭੂਮਿਕਾ ਨਾ ਨਿਭਾਉਣ ਤਾਂ ਖੇਤਰ ਕੋਈ ਵੀ ਤਰੱਕੀ ਨਹੀਂ ਕਰ ਸਕਦਾ